ਪਰਸੋਂ ਰਾਤ ਜੀ ਮੈਂ ਇੱਕ ਵਿਆਹ ਪਾਰਟੀ 'ਤੇ ਗਿਆ ਸੀਗਾ ਅਤੇ ਮੇਰੀ ਫੈਮਲੀ ਵੀ ਨਾਲ ਸੀਗੀ ਅਤੇ ਸਾਨੂੰ ਆਏਂ ਸੀ ਵੀ ਛੇ ਸੱਤ ਵਜਦੇ ਨੂੰ ਅਸੀਂ ਆ ਜਾਵਾਂਗੇ ਅਤੇ ਪਰ ਉੱਥੇ ਲੇਟ ਹੋ ਗਈ ਪਾਰਟੀ ਦੇਰ ਰਾਤ ਤੱਕ ਚੱਲੀ ਅਤੇ ਇਸ ਕਰਕੇ ਸਾਨੂੰ ਫਿਰ ਅਸੀਂ ਕੋਈ ਕੈਬ ਨੂੰ ਹਾਇਰ ਕੀਤਾ ਫੋਨ ਕੀਤਾ ਮੈਂ ਅਤੇ ਉਹ ਆ ਗਏ ਬਾਈ ਜੀ ਅਤੇ ਅਸੀਂ ਉੱਥੋਂ ਤੁਰ ਪਏ ਅਤੇ ਰਾਹ 'ਚ ਅਸੀਂ ਦੋ ਤਿੰਨ ਵਾਰੀ ਰੁਕੇ ਵੀ ਬੱਚੇ ਨੇ ਬਾਸ਼ਰੂਮ ਕਰਨਾ ਸੀਗਾ ਅਤੇ ਇਸ ਤਰ੍ਹਾਂ ਕਰਕੇ ਪਰ ਉਹ ਵਧੀਆ ਬੰਦਾ ਬਹੁਤ ਵਧੀਆ ਸੀਗਾ ਅਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਵੀ ਸਾਨੂੰ ਤੁਸੀਂ ਵਾਰ ਵਾਰ ਰੋਕੀ ਜਾਂਦੇ ਹੋ ਵੀ ਮੇਰਾ ਟਾਈਮ ਖਰਾਬ ਹੁੰਦਾ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕੀਤੀ ਅਤੇ ਸਾਨੂੰ ਵਧੀਆ ਸੁਰੱਖਿਅਤ ਆਪਣੇ ਪਰਿਵਾਰ ਵਾਂਗੂੰ ਹੀ ਘਰ ਛੱਡਤਾ ਸੀ ਉਹਨਾਂ ਨੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਆ ਕੇ ਸਾਨੂੰ ਬਹੁਤ ਬਹੁਤ ਧੰਨਵਾਦ ਵੀਰ ਜੀ ਥੈਂਕ ਯੂ ਧੰਨਵਾਦ